ਸਤਿ ਸ਼੍ਰੀ ਅਕਾਲ ਸਾਡੇ ਘਰ ਵਿੱਚ ਨਵੀਂ ਟੈਕਨੋਲੋਜੀ ਦੇ ਬਹੁਤ ਹੀ ਯੰਤਰ ਹਨ ਜਿਵੇਂ ਇਲੈਕਟਰੋਨਿਕ ਪੱਖਾ ਅਸੀਂ ਪੱਖੇ ਦੇ ਨਾਲ ਠੰਡੀ ਹਵਾ ਲੈ ਸਕਦੇ ਹਾਂ ਫਿਰ ਅ ਗੀਜ਼ਰਜ਼ ਗੀਜ਼ਰ ਸਾਨੂੰ ਗਰਮ ਪਾਣੀ ਦਿੰਦੇ ਆ ਠੰਡਾ ਵਿੱਚ ਅਸੀਂਤੇ ਇਲੈਕਟਰੋਨਿਕ ਫਿਰ ਮਸ਼ੀਨਸ ਮਸ਼ੀਨਸ ਸਾਨੂੰ ਮਤਲਬ ਜੇ ਕੁਛ ਅਸੀਂ ਪੀਸਣਾ ਹੋਵੇ ਉਹਦੇ ਕਾਰਨ ਸਾਡੇ ਕੰਮ ਆਉਂਦੀ ਹੈ ਅਤੇ ਫਿਰ ਇਲੈਕਟ੍ਰੋਨਿਕ ਨ ਵੋਸ਼ਿੰਗ ਮਸ਼ੀਨਸ ਜਿਹਦੇ ਨਾਲ ਅਸੀਂ ਆਪਣੇ ਕੱਪੜੇ ਧੋ ਸਕਦੇ ਹਾਂ ਅਤੇ ਅਤੇ ਅ ਦੇਖ ਸਕਦੇ ਆਂ ਜੇ ਅਸੀਂ ਜੇ ਅਸੀਂ ਮਤਲਬ ਕੁਝ ਅ ਜੇ ਅਸੀਂ ਵੇਲੇ ਹਾਂ ਵਿਹਲੇ ਹਾਂ ਤਾਂ ਅਸੀਂ ਟੀ ਵੀ ਵੇਖ ਸਕਦੇ ਹਾਂ ਅਤੇ ਫਿਰ ਇਲੈਕਟਰੋਨਿਕ ਜਿੱਦਾਂ ਸਕੂਟੀ ਸਕੂਟੀ 'ਤੇ ਜਾਣ ਲਈ ਅਸੀਂ ਇੱਦਾਂ ਅਸੀਂ ਪੈਦਲ ਜਾਂਦੇ ਹਾਂ ਅਤੇ ਸਕੂਟੀ 'ਚ ਅਸੀਂ ਜਲਦੀ ਜਾ ਸਕਦੇ ਹਾਂ ਕਿਤੇ ਪੁੱਜੇ ਹਾਂ